ਹੈਲੋ ਹਾਂਜੀ ਗੋਪਾਲ ਰੈਸਟੋਰੈਂਟ ਤੋਂ ਬੋਲਦੇ ਹੋ ਜੀ ਐਕਚੁਲੀ ਅਸੀਂ ਔਡਰ ਕਰਨਾ ਸੀਗਾ ਲੰਚ ਦੇ ਲਈ ਅਤੇ ਕਿਰਪਾ ਕਰਕੇ ਆਪਣਾ ਇੱਕ ਮੈਨਿਊ ਦੱਸ ਦਿਓ ਅਤੇ ਮੈਨਿਊ ਦੇ ਨਾਲ ਨਾਲ ਜਿਹੜਾ ਕੁਛ ਅਸੀਂ ਐਡ ਕਰ ਦਿੰਨਾ ਮੈਂ ਕਿ ਇੱਕ ਸ਼ਾਹੀ ਪਨੀਰ ਕਰ ਦਿਓ ਅਤੇ ਨਾਲ ਸੈਲਡ ਕਰ ਦਿਓ ਅਤੇ ਦਸ ਚਪਾਤੀ ਜਿਹੜੀ ਆ ਉਹ ਕਰ ਦਿਓ ਅਤੇ ਕਿਰਪਾ ਕਰਕੇ ਇਹਨੂੰ ਅੱਜ ਦੁਪਹਿਰ ਦੋ ਵਜੇ ਤੱਕ ਮਿਤੀ ਦਸ ਇੱਕ ਦੋ ਹਜ਼ਾਰ ਚੌਬੀ ਤੱਕ ਇਹਨੂੰ ਭੇਜਣ ਦੀ ਕਿਰਪਾ ਕਰਿਓ ਅਤੇ ਨਾਲ ਦੀ ਨਾਲ ਕੁਝ ਡਿਸਕਾਊਂਟ ਬਾਰੇ ਵੀ ਮੈਨੂੰ ਜ਼ਰੂਰ ਦੱਸਿਓ